ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਨੇ ਭਾਅ ਜੀ ਹੋਰ ਘਰ ਪਰਿਵਾਰ ਠੀਕ ਨੇ ਭਾਅ ਜੀ ਵਧੀਆ ਵਧੀਆ ਸਾਡੇ ਭਾਅ ਜੀ ਮੈਂ ਨਾ ਗੁਰਦਾਸਪੁਰ ਵਿੱਚ ਨਵਾਂ ਆਇਆਂ ਮੇਰੇ ਨਾ ਥਾਣੇ ਲਾਗੇ ਘਰ ਆ ਅਤੇ ਮੈਂ ਨਾ ਭਾਅ ਜੀ ਫਿਸ਼ ਪਾਰਕ ਜਾਣਾ ਆ ਮੈਨੂੰ ਨਾ ਭ ਭਾਅ ਜੀ ਮੈਂ ਨਵਾਂ ਆਇਆਂ ਅਤੇ ਮੈਨੂੰ ਫਿਸ਼ ਪਾਰਕ ਦਾ ਰਾਹ ਨਹੀਂ ਪਤਾ ਅਤੇ ਤਾਂ ਕਰਕੇ ਨਾ ਤੁਸੀਂ ਮੈਨੂੰ ਰਾਹ ਦੱਸ ਭਾਅ ਜੀ ਮੈਂ ਹਨੂੰਮਾਨ ਚੌਂਕ ਦੇ ਲਾਗੇ ਜਿਹੜਾ ਥਾਣਾ ਉਹਦੇ ਨਾਲ ਹੀ ਸਾਡਾ ਖੱਬੇ ਬੰਨੇ ਹੀ ਘਰ ਹੈ ਸਾਡਾ ਹਾਂਜੀ ਹਾਂਜੀ ਅਤੇ ਭਾਅ ਜੀ ਹਾਂਜੀ ਕਿੱਧਰ ਹਾਂਜੀ ਹਾਂਜੀ ਲੱਭਣ ਡਿਆ ਲੱਭਣ ਡਿਆ ਹਾਂਜੀ ਹੈਗੇ ਜੀ ਹਾਂਜੀ ਭਾਅ ਜੀ ਜੇ ਮੈਂ ਉਹਨਾਂ ਨੂੰ ਹੀ ਕਹਿਣਾ ਤਾਂ ਫੇਰ ਮੈਂ ਤੁਹਾਨੂੰ ਕਾਹਤੋਂ ਫੋਨ ਲਾਇਆ ਅਤੇ ਮੈਨੂੰ ਭਾਅ ਜੀ ਪਹਿਲਾਂ ਦੱਸਦੇ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਫਿਸ਼ ਪਾਰਕ ਉਹ ਲੈ ਜਾਂਦੇ ਮੈਨੂੰ ਹਾਂਜੀ ਜਹਾਜ਼ ਚੌਂਕ ਹਾਂਜੀ ਹਾਂਜੀ ਖੱਬੇ ਹੱਥ ਹਾਂਜੀ ਹਾਂਜੀ ਮੈਂ ਨਾ ਭਾਅ ਜੀ ਓਕੇ ਪਰਫੈਕਟ ਆ ਮੈਨੂੰ ਹੁਣ ਸਾਰਾ ਤੁਹਾਡਾ ਪਤਾ ਲੱਗ ਗਿਆ ਜਿੱਦਾਂ ਤੁਸੀਂ ਦੱਸਿਆ ਮੈਨੂੰ ਡਿਟੇਲ ਵਿੱਚ ਮੈਂ ਨਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮੈਨੂੰ ਦੱਸਿਆ ਹੈ ਹੁਣ ਮੈਂ ਕਦੀ ਵੀ ਇਹ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ ਮੈਂ ਆਪਣੀ ਘਰਦੀ ਨੂੰ ਵੀ ਲੈ ਕੇ ਆਊ ਅਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਊ ਫਿਸ਼ ਪਾਰਕ 'ਚ ਮੈਂ